ਪੰਜਾਬੀ ਭਾਸ਼ਾ ਪੰਜਾਬ ਦੀ ਮਾਂ ਬੋਲੀ ਹੈ ਪੰਜਾਬ ਵਿੱਚ ਇਹ ਬਹੁਤ ਹੀ ਪ੍ਰਸਿੱਧ ਹੈ ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਉੱਥੇ ਵੀ ਪੰਜਾਬੀ ਬੋਲਦੇ ਹਨ ਪੰਜਾਬ ਪੰਜਾਬੀ ਬੋਲਣ ਵਾਲਿਆਂ ਲਈ ਬਹੁਤ ਪ੍ਰਸਿੱਧ ਹੈ ਪਰ ਅੱਜ ਕੱਲ੍ਹ ਪੰਜਾਬੀ ਵਿੱਚ ਬਹੁਤ ਤਬਦੀਲੀਆਂ ਆਈਆਂ ਹਨ ਜਿਵੇਂ ਹਰ ਕੋਈ ਅੰਗਰੇਜ਼ੀ ਵੱਲ ਭੱਜਦਾ ਹੈ ਅੱਜ ਕੱਲ੍ਹ ਅੰਗਰੇਜ਼ੀ ਨੂੰ ਪਹਿਲ ਦਿੱਤੀ ਜਾਂਦੀ ਹੈ ਪੰਜਾਬੀ ਨੂੰ ਦਬਾਇਆ ਜਾ ਰਿਹਾ ਹੈ ਪਰ ਸਾਨੂੰ ਸਾਨੂੰ ਪੰਜਾਬੀ ਭੁਲਾਉਣੀ ਨਹੀਂ ਚਾਹੀਦੀ ਕਿਉਂਕਿ ਪੰਜਾਬੀ ਬੋਲਣਾ ਸਾਡਾ ਪੰਜਾਬ ਦੀ ਖਾਸੀਅਤ ਹੈ ਇਹ ਇਸ ਇਹ ਸਾਡੇ ਲਈ ਮਾਣ ਦੀ ਗੱਲ ਹੈ ਪੰਜਾਬੀ ਬੋਲਣਾ